ਆਨੰਦਪੁਰ ਸਾਹਿਬ ਸਿੱਖਾਂ ਦਾ ਇੱਕ ਧਾਰਮਿਕ ਸਥਾਨ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸੋਲਾਂ ਸੌ ਨੜਿੱਨਵੇਂ ਈਸਵੀ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਇਹ ਸਿੱਖਾਂ ਦਾ ਇੱਕ ਸਿਰਮੌਰ ਸਥਾਨ ਹੈ ਇੱਥੇ ਬਹੁਤ ਬੜਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਇੱਥੇ ਹਰੇਕ ਸਿੱਖ ਆਪਣੀ ਧਾਰਮਿਕ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ ਇੱਥੇ ਇੱਕ ਲੰਗਰ ਦੀ ਵੀ ਬਹੁਤ ਵੱਡੀ ਪ੍ਰਥਾ ਚੱਲਦੀ ਹੈ ਲੰਗਰ ਸਾਹਿਬ ਹਾਲ ਬਹੁਤ ਵੱਡਾ ਹੈ ਇੱਥੇ ਜੋ ਹਰ ਕਿਸੇ ਜਾਤੀ ਜਾ ਧਰਮ ਤੋਂ ਉੱਪਰ ਉੱਠ ਕੇ ਲੰਗਰ ਛਕਾਇਆ ਜਾਂਦਾ ਹੈ ਸੰਗਤਾਂ ਨੂੰ ਇੱਥੇ ਬਹੁਤ ਵਧੀਆ ਆਲ਼ਾ ਦੁਆਲਾ ਬਹੁਤ ਸਾਫ਼ ਸੁਥਰਾ ਮੌਸਮ ਵਾਤਾਵਰਨ ਵਧੀਆ ਰਹਿੰਦਾ ਹੈ ਇਹ ਸਿੱਖਾਂ ਦਾ ਇੱਕ ਸਿਰਮੌਰ ਅਤੇ ਸਰਬ ਉੱਚ ਸਥਾਨ ਹੈ ਜਿੱਥੇ ਹਰ ਇੱਕ ਸਿੱਖ ਬੜੀ ਸ਼ਰਧਾ ਦੇ ਫੁੱਲ ਭੇਂਟ ਕਰਨ ਜਾਂਦਾ ਹੈ